ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਨਵਪ੍ਰੀਤ ਸਿੰਘ ਹੈ ਅਤੇ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਮੈਂ ਅੱਜ ਤੋਂ ਦਸ ਦਿਨ ਪਹਿਲਾਂ ਤੁਹਾਡੇ ਫਲਿੱਪਕਾਰਡ ਸਾਈਟ ਤੋਂ ਆਪਣੇ ਲਈ ਹੈਡਫੋਨ ਬੁੱਕ ਕੀਤੇ ਸੀ ਜਿਹੜੇ ਅੱਜ ਮੇਰੇ ਕੋਲ ਪਹੁੰਚੇ ਆ ਜੋ ਕਿ ਬਹੁਤ ਲੇਟ ਸਮਾਂ ਨਿਰਧਾਰਿਤ ਕੀਤੇ ਤੋਂ ਬਹੁਤ ਲੇਟ ਹੈ ਅਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਹੈਡਫੋਨ ਬਿਲਕੁਲ ਹੀ ਖ਼ਰਾਬ ਹਨ ਜੋ ਮੈਂ ਬੁੱਕ ਕੀਤੇ ਸਨ ਉਹ ਬਿਲਕੁਲ ਨਹੀਂ ਹਨ ਜੋ ਉਸ ਤੁਹਾਡੀ ਐਪ 'ਤੇ ਜੋ ਵਿਖਾਇਆ ਗਿਆ ਸੀ ਉੱਦਾਂ ਦੇ ਬਿਲਕੁਲ ਨਹੀਂ ਹਨ ਮੈਂ ਬਹੁਤ ਉਮੀਦਾਂ ਨਾਲ ਬਹੁਤ ਮੁ ਮੁਸ਼ਕਿਲ ਨਾਲ ਪੈਸੇ ਇਕੱਠੇ ਕਰਕੇ ਇਹ ਹੈਡਫੋਨ ਮੰਗਵਾਏ ਹਨ ਜਿਹੜੇ ਕਿ ਮੇਰੀ ਪੜ੍ਹਾਈ ਲਈ ਬਹੁਤ ਜ਼ਰੂਰੀ ਹਨ ਅਤੇ ਮੈਂ ਜਦੋਂ ਉਹਨਾਂ ਨੂੰ ਵੇਖਿਆ ਤਾਂ ਇਹ ਬਿਲਕੁਲ ਖ਼ਰਾਬ ਹਨ ਵਾਇਰਸ ਟੁ ਵਾਇਰ ਸਭ ਟੁੱਟਾ ਹੋਇਆ ਵਾ ਅਤੇ ਇਹ ਹੈ ਵੀ ਡੀਫੈਕਟਿਵ ਪੀਸ ਆ ਅਤੇ ਜਿਹੜਾ ਜੋ ਬੰਦਾ ਮੈਨੂੰ ਇਹ ਹੈਡਫੋਨ ਦੇਣ ਆਇਆ ਸੀ ਉਹ ਬਿਲਕੁਲ ਚੱਜ ਨਾਲ ਗੱਲ ਨਹੀਂ ਕਰ ਰਿਹਾ ਸੀ ਬਹੁਤ ਗਲਤ ਲਫਜ਼ ਇਸਤੇਮਾਲ ਕਰ ਰਿਹਾ ਸੀ ਮੇਰੇ ਨਾਲ ਗੱਲ ਕਰਦੇ ਵਕਤ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਦਸ ਦਿਨ ਪਹਿਲਾਂ ਮੈਂ ਇਹ ਆਡਰ ਬੁੱਕ ਕੀਤਾ ਸੀ ਜੋ ਕਿ ਹੁਣ ਪਹੁੰਚਿਆ ਵਾ ਅਤੇ ਬਿਲਕੁਲ ਗਲਤ ਆ ਤੁਹਾਡੀ ਇਹ ਪ੍ਰੋਡਕਟ ਵੀ ਬਿਲਕੁਲ ਸਹੀ ਨਹੀਂ ਆ ਅਤੇ ਇੰਨੇ ਦਿਨਾਂ ਬਾਅਦ ਆਉਣ ਦੇ ਨਾਲ ਨਾਲ ਮੈਨੂੰ ਲੱਗਦਾ ਹੈ ਕਿ ਤੁਸੀਂ ਗਲਤ ਪ੍ਰੋਡਕਟ ਦੇ ਦਿੱਤਾ ਹੈ ਇੰਨਾ ਇੰਤਜ਼ਾਰ ਦੇ ਬਾਅਦ ਵੀ ਗਲਤ ਪ੍ਰੋਡਕਟ ਮਿਲੇ ਤਾਂ ਚੰਗੀ ਗੱਲ ਨਹੀਂ ਹੈ ਮੈਂ ਇਹ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਤੁਸੀਂ ਮੈਨੂੰ ਜਲਦ ਤੋਂ ਜਲਦ ਰਿਟਰਨ ਇਹ ਕਰਵਾਉਣ ਦੀ ਕੋਈ ਸਕੀਮ ਦੱਸੋ ਤਾਂ ਕਿ ਮੈਂ ਜਲਦ ਤੋਂ ਜਲਦ ਨਵੇਂ ਕੋਈ ਹੋਰ ਵਧੀਆ ਹੈਡਫੋਨ ਮੰਗਵਾ ਪਾਵਾਂ ਮੈਨੂੰ ਇਹ ਉਮੀਦ ਨਹੀਂ ਸੀ ਤੁਹਾਡੀ ਕੰਪਨੀ ਤੋਂ ਕਿ ਇੰਨਾ ਗਲਤ ਡਿਫੈਕਟਿਵ ਪੀਸ ਮੈਨੂੰ ਮਿਲੇਗਾ ਪਰ ਹੁਣ ਇਹ ਦੇਖ ਕੇ ਮੈਨੂੰ ਲੱਗਦਾ ਕਿ ਮੈਨੂੰ ਕੋਈ ਹੋਰ ਕੰਪਨੀ ਤੋਂ ਮੰਗਵਾਣੇ ਚਾਹੀਦੇ ਸੀ ਇਹ ਬਿਲਕੁਲ ਹੀ ਖ਼ਰਾਬ ਡਿਫੈਕਟਿਵ ਪੀਸ ਹਨ ਇਹ ਬਿਲਕੁਲ ਨਹੀਂ ਚਲਦੇ ਇਹਦੇ ਸਵਿੱਚ ਸਭ ਟੁੱਟੇ ਹਾ ਬੋਟ ਕੰਪਨੀ ਦੇ ਇਹ ਹੈਡਫੋਨ ਹਨ ਅਤੇ ਜੋ ਕਿ ਖ਼ਰਾਬ ਹਨ ਅਤੇ ਮੈਨੂੰ ਜਲਦੀ ਤੋਂ ਜਲਦੀ ਰਿਟਰਨ ਕਰਵਾਉਣ ਦੀ ਸਕੀਮ ਦੱਸੀ ਜਾਵੇ ਧੰਨਵਾਦ